ਹੈਲੋ ਸਤਿ ਸ਼੍ਰੀ ਅਕਾਲ ਸਰ ਫਾਸਟਵੇਵ ਟੈਕਸੀ ਕੰਪਨੀ ਤੋਂ ਦੇ ਡਰਾਈਵਰ ਬੋਲ ਰਹੇ ਹੋ ਹਾਂਜੀ ਆਹ ਤੁਸੀਂ ਹੁਣੇ ਹੁਣੇ ਨਾ ਮੈਨੂੰ ਪੰਜ ਕੁ ਮਿੰਟ ਪਹਿਲਾਂ ਆਪਦੇ ਸਥਾਨ 'ਤੇ ਪਹੁੰਚਾਇਆ ਅਤੇ ਮੈਂ ਆਪਣੇ ਅੰਦਰ ਕੌਨਫਰੈਂਸ ਮੀਟਿੰਗ 'ਚ ਚਲੀ ਗਈ ਹਾਂ ਅਤੇ ਮੈਂ ਨਾ ਤੁਹਾਨੂੰ ਦੱਸਣਾ ਸੀ ਕਿ ਇੱਕ ਛੋਟੀ ਜਿਹੀ ਦਿੱਕਤ ਆ ਗਈ ਕਿ ਹੁਣ ਮੈਂ ਇਸ ਮੀਟਿੰਗ 'ਚੋਂ ਨਾ ਬਾਹਰ ਨਹੀਂ ਆ ਸਕਦੀ ਮੈਨੂੰ ਕਾਫੀ ਸਮਾਂ ਲੱਗ ਸਕਦਾ ਅਤੇ ਤੁਹਾਨੂੰ ਮੈਂ ਜਿਹੜਾ ਕਰਾਇਆ ਹੈਗਾ ਟੈਕਸੀ ਦਾ ਹੈ ਨਾ ਉਹ ਭੇਜਣਾ ਹੈਗਾ ਅਤੇ ਮੈਂ ਤੁਹਾਨੂੰ ਤੁਹਾਨੂੰ ਕਹਿੰਦੀ ਸੀ ਤੁਹਾਡੇ ਕੋਲ ਕੋਈ ਯੂ ਪੀ ਆਈ ਆਈ ਡੀ ਹੈ ਤੁਹਾਡੀ ਵੀ ਮੈਂ ਤੁਹਾਨੂੰ ਔਨਲਾਈਨ ਜਿਹੜਾ ਮੇਰਾ ਕਰਾਇਆ ਬਣਿਆ ਉਹ ਮੈਂ ਤੁਹਾਨੂੰ ਭੇਜ ਦਿੰਦੀ ਹਾਂ ਕਿਉਂਕਿ ਇੱਥੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗ ਜਾਣਾ ਹੈ ਨਾ ਅਤੇ ਇੰਨਾ ਸਮਾਂ ਤੁਹਾਨੂੰ ਇੱਥੇ ਖੜ੍ਹਨਾ ਮੁਸ਼ਕਿਲ ਹੈ ਅਤੇ ਤੁਸੀਂ ਮੈਨੂੰ ਆਪਣਾ ਕੋਈ ਵੀ ਫੋਨਪੇਅ ਗੂਗਲ ਪੇਅ ਜਾਂ ਕੋਈ ਵੀ ਤੁਹਾਡੀ ਆਈ ਡੀ ਹੈ ਔਨਲਾਈਨ ਦੀ ਜਿਹਦੇ 'ਤੇ ਮੈਂ ਪੇਅ ਕਰ ਸਕਾਂ ਤੁਹਾਨੂੰ ਕਰਾਇਆ ਤੁਸੀਂ ਮੈਨੂੰ ਉਹ ਆਪਣੀ ਭੇਜ ਦਿਓ ਆਈ ਡੀ ਅਤੇ ਮੈਂ ਤੁਹਾਨੂੰ ਹੁਣੀ ਜਿਹੜੇ ਪੈਸੇ ਹੈਗੇ ਉਹ ਉੱਧਰ ਟਰਾਂਸਫਰ ਕਰ ਦਿੰਦੀ ਹਾਂ ਅਤੇ ਤੁਸੀਂ ਚੈੱਕ ਵੀ ਕਰ ਲਿਓ ਚੈੱਕ ਕਰਕੇ ਫਿਰ ਮੈਨੂੰ ਤੁਸੀਂ ਟੈਕਸਟ ਮੈਸੇਜ ਰਾਹੀਂ ਮੈਸੇਜ ਕਰ ਦਿਓ ਵੀ ਤੁਹਾਡੇ ਕੋਲ ਜਿਹੜੇ ਪੈਸੇ ਹੈਗੇ ਪਹੁੰਚ ਗਏ ਕਿ ਨਹੀਂ ਅਤੇ ਤੁਸੀਂ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜਿਹੜਾ ਤੁਸੀਂ ਆਈ ਡੀ ਨੰਬਰ ਭੇਜਣਾ ਨਾ ਬਿਲਕੁਲ ਸਹੀ ਭੇਜਿਓ ਮੈਨੂੰ ਸਾਫ ਸਾਫ ਅੱਖਰਾਂ 'ਚ ਲਿਖ ਕੇ ਤਾਂ ਕਿ ਮੈਨੂੰ ਚੰਗੀ ਤਰਾਂ ਸਮਝ ਆ ਸਕੇ ਅਤੇ ਜਿਹੜਾ ਤੁਹਾਡਾ ਕਿਰਾਇਆ ਹੈਗਾ ਜਿਹੜਾ ਟੈਕਸੀ ਦਾ ਬਣਦਾ ਉਹ ਤੁਹਾਡੇ ਸਹੀ ਖਾਤੇ ਵਿੱਚ ਪੈ ਸਕੇ ਤਾਂ ਮੈਨੂੰ ਤੁਸੀਂ ਮੇਰੇ ਇਸ ਨੰਬਰ 'ਤੇ ਆਪਦਾ ਆਈ ਡੀ ਨੰਬਰ ਭੇਜ ਦਿਓ